ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹੋਰ ਸੁਣਾਓ ਮੈਮ ਕਿੱਦਾਂ ਹਾਂਜੀ ਮੈਂ ਹਾਂਜੀ ਬਸ ਠੀਕ ਆ ਤੁਸੀਂ ਮੈਨੂੰ ਹੀ ਕੋਲ ਕੀਤੀ ਆ ਮੈਂ ਕੁਲਦੀਪ ਬੋਲਦੀ ਹਾਂ

ਹਾਂਜੀ ਹਾਂਜੀ ਹੋਰ ਸੁਣਾਓ ਕਿੱਦਾਂ ਹੋਰ ਕਿੱਦਾਂ ਸਕੂਲ ਕਿੱਦਾਂ ਚਲਦਾ ਤੁਹਾਡਾ ਅੱਛਾ ਹਾਂਜੀ ਹਾਂਜੀ ਹਾਂਜੀ ਹਾਂਜੀ ਬਹੁਤ ਔਖਾ ਹੈ ਜੀ ਟੀਚਿੰਗ ਵਾਲਾ ਜਿਹੜਾ ਹੁਣ ਪੰਜਾਬ ਹਾਂ ਔਖਾ ਹੋ ਜਾਊ ਹਾਂਜੀ ਹਾਂਜੀ ਹਾਂਜੀ ਹਾਂਜੀ ਉਹੀ ਤਾਂ ਹੈ ਤੁਹਾਡੇ ਵੀ ਆਹੀ ਪ੍ਰੋਬਲਮਸ ਆ ਕੇ ਉਹ ਹੁਣ ਰੂਲਸ ਵੀ ਇੱਦਾਂ ਦੇ ਬਣਾ ਲੈਂਦੇ ਆ ਕੇ ਬਈ ਟੀਚਰ ਆਪਣੇ ਆਪ ਕੋਈ ਡਿਸੀਜ਼ਨ ਨਹੀਂ ਲੈ ਸਕਦਾ ਬੱਚੇ ਨਾਲ ਰਿਲੇਟਡ ਹਰ ਚੀਜ਼ ਉਹਨਾਂ ਦੀ ਪਰਮਿਸ਼ਨ ਤੋਂ ਬਗੈਰ ਅਸੀਂ ਕਰ ਨਹੀਂ ਸਕਦੇ ਕੁਛ ਵੀ ਅਤੇ ਬੱਚੇ ਨੂੰ ਕੋਈ ਪ੍ਰੋਬਲਮ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਟੀਚਰ 'ਤੇ ਜੇ ਉਹ ਵੈਸੇ ਹੀ ਕੋਈ ਗੱਲ ਹੁੰਦੀ ਆ ਤਾਂ ਵੀ ਟੀਚਰ ਨੂੰ ਹੀ ਫੇਸ ਕਰਨੀ ਪੈਂਦੀ ਆ ਪੇਰੈਂਟਸ ਵੱਲੋਂ ਵੀ ਪ੍ਰੈਸ਼ਰ ਅਤੇ ਉਹ ਮੈਨੇਜਮੈਂਟ ਵੱਲੋਂ ਵੀ ਪ੍ਰੈਸ਼ਰ ਪ੍ਰੋਬਲਮਸ ਤਾਂ ਬਹੁਤ ਆ ਰਹੀਆਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਉਹੀ ਤਾਂ ਹੈਗਾ ਆ ਕਿ ਇਸੇ ਕਰਕੇ ਤਾਂ ਜਿਹੜੇ ਬੱਚੇ ਆ ਉਹਨਾਂ ਵਿੱਚ ਡਿਸਿਪਲਨ ਦੀ ਕਮੀ ਆ ਰਹੀ ਅਨੁਸ਼ਾਸਨ ਨਹੀਂ ਹੈਗਾ ਬੱਚਿਆਂ ਵਿੱਚ ਉਹ ਟੀਚਰ ਦੀ ਨਾ ਤਾਂ ਮਾਣ ਸਤਿਕਾਰ ਕਰਦੇ ਹਾਂ ਜਿਵੇਂ ਕਿ ਸਾਡੇ ਟਾਈਮ ਨਾਲ ਅਸੀਂ ਜਦੋਂ ਪੜ੍ਹਦੇ ਹੁੰਦੇ ਸੀ ਤਾਂ ਅਸੀਂ ਟੀਚਰਸ ਨਾਲ ਬਹੁਤ ਜ਼ਿਆਦਾ ਆਪਣੇ ਅਧਿਆਪਕਾਂ ਦਾ ਮਾਣ ਆਦਰ ਕਰਦੇ ਸੀਗੇ ਅਤੇ ਹੁਣ ਦੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਹੈ ਕਿ ਸਾਡਾ ਅਧਿਆਪਕ ਆ ਅਸੀਂ ਇਹਨਾਂ ਨਾਲ ਕਿੱਦਾਂ ਵਿਵਹਾਰ ਕਰਨਾ ਆ ਕਿਵੇਂ ਉਹਨਾਂ ਨੂੰ ਆਪਾਂ ਵਿਸ਼ ਕਰਨਾ ਜਾ ਉਹਨਾਂ ਨੂੰ ਅਸੀਂ ਉਹਨਾਂ ਨੂੰ ਪਤਾ ਹੀ ਨਹੀਂ ਆ ਉਹ ਕਲਾਸ ਦੇ ਵਿੱਚ ਵੀ ਜਮਾਤ ਵਿੱਚ ਵੀ ਉਹਨਾਂ ਦਾ ਜਿਹੜਾ ਵਿਵਹਾਰ ਆ ਉਹ ਬਿਲਕੁਲ ਹੀ ਆਪਾਂ ਮਤਲਬ ਟੀਚਰ ਵੱਲ ਤਾਂ ਬਸ ਅਤੇ ਬੜਾ ਮੁਸ਼ਕਿਲ ਹੋ ਜਾਂਦਾ ਆ ਕਿ ਉਹ ਕਿੱਦਾਂ ਕਲਾਸ ਨੂੰ ਕੰਟਰੋਲ ਕਰੇ ਕਿੱਦਾਂ ਉਹਨਾਂ ਨੂੰ ਪੁ ਆਪਣੇ ਵੱਲ ਧਿਆਨ ਉਹਨਾਂ ਦਾ ਲਵਾ ਕੇ ਅਤੇ ਪੜ੍ਹਾਈ ਵੱਲ ਧਿਆਨ ਉਹਨਾਂ ਦਾ ਲਗਾਵੇ ਕਿਉਂਕਿ ਹਰ ਵੇਲੇ ਤਾਂ ਉਹਨਾਂ ਦਾ ਧਿਆਨ ਸ਼ਰਾਰਤਾਂ ਵਿੱਚ ਰਹਿੰਦਾ ਕਾਰਨ ਇਹ ਆ ਕਿ ਵੀ ਡਰ ਨਹੀਂ ਹੈਗਾ ਉਹਨਾਂ ਦੇ ਵਿੱਚ ਅਤੇ ਵਈ ਟੀਚਰਸ ਉਹਨਾਂ ਨੂੰ ਵੀ ਪਤਾ ਹੈ ਕਿ ਸਕੂਲ ਜਿਹੜਾ ਆ ਉਹ ਇੱਦਾਂ ਦੇ ਰੂਲ ਪੋਲਸੀਸ ਬਣਾਈਆਂ ਹੋਈਆਂ ਜਿਹੜੀਆਂ ਕਿ ਟੀਚਰ ਨੂੰ ਅਲਾਊ ਨਹੀਂ ਹੈਗਾ ਅਲਾਊਡ ਹੀ ਨਹੀਂ ਹੈਗਾ ਕਿ ਉਹ ਮਤਲਬ ਕੋਈ ਵੀ ਅਤੇ ਉਹ ਬੱਚੇ ਨੂੰ ਕੁਛ ਕਹਿ ਸਕੇ ਆਪਣੇ ਆਪ ਡਿਸੀਜ਼ਨ ਲੈ ਸਕੇ ਈਵਨ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਉਹ ਤਾਂ ਹੈ ਮੈਮ ਇੱਦਾਂ ਹੀ ਹੈ ਇਸੇ ਕਰਕੇ ਹੀ ਬਸ ਹੈ ਅਨੁਸ਼ਾਸਨ ਦੀ ਕਮੀ ਬੱਚਿਆਂ ਵਿੱਚ ਇਸੇ ਕਰਕੇ ਉਹ ਤਾਂ ਹੀ ਤਾਂ ਆਪਣੇ ਮਾਪਿਆਂ ਦਾ ਵੀ ਆਦਰ ਨਹੀਂ ਕਰਦੇ ਟੀਚਰਾਂ ਦਾ ਵੀ ਨਹੀਂ ਕਰਦੇ ਹੈਗੇ ਅਤੇ ਚਲੋ ਹਾਂਜੀ ਚਲੋ ਮੈਮ ਠੀਕ ਆ ਹੁਣ ਥੋੜ੍ਹਾ ਜਿਹਾ ਮੈਨੂੰ ਨਾ ਹਾਂਜੀ ਕੰਮ ਆ ਗਿਆ ਮੈਂ ਥੋੜ੍ਹਾ ਜਾਣਾ ਹੈ ਇਸ ਕਰਕੇ ਅਸੀਂ ਫਿਰ ਕਦੇ ਗੱਲ ਕਰਾਂਗੇ ਇਸ ਵਿਸ਼ੇ 'ਤੇ ਹਾਂਜੀ ਓਕੇ ਓਕੇ ਜੀ ਨਮਸ਼ਕਾਰ ਜੀ